ਜਦੋਂ ਅਸੀਂ ਆਨਲਾਈਨ ਸਲੰਡਰ ਗੈਸ ਬੁਕਿੰਗ ਕਰਦੇ ਹਾਂ ਤਾਂ ਸਾਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕਾਰਨ ਕਈ ਵਾਰ ਸਾਨੂੰ ਸਮੇਂ ਸਿਰ ਗੈਸ ਸਲੰਡਰ ਬੁਕਿੰਗ ਕਰਾਉਣ ਦੀ ਲੋੜ ਪੈਂਦੀ ਹੈ ਅਤੇ ਕਈ ਵਾਰ ਫੋਨਾਂ ਵਿੱਚ ਬੈਲੈਂਸ ਨਾ ਹੋਣ ਕਾਰਨ ਸਾਨੂੰ ਗੈਸ ਸਲੰਡਰ ਬਲੈਕ ਵਿੱਚ ਵੀ ਲੈਣਾ ਪੈਂਦਾ ਹੈ ਜਿਸ ਕਾਰਨ ਸਾਨੂੰ ਬਹੁਤ ਸਾਰੇ ਪੈਸੇ ਵੇਸਟ ਜਾਂਦੇ ਹਨ ਅਤੇ ਸਾਨੂੰ ਜਿਹੜੇ ਸਾਡੇ ਪੁਰਾਣੇ ਗਾਹਕ ਹੁੰਦੇ ਆ ਪਲੀਜ ਉਹਨਾਂ ਨੂੰ ਆਨਲਾਈਨ ਬੁਕਿੰਗ ਦੇ ਦੁਆਰਾ ਸਲੰਡਰ ਛੇਤੀ ਤੋਂ ਛੇਤੀ ਦਿੱਤਾ ਜਾਵੇ ਅਤੇ ਫੋਨ ਰਾਹੀਂ ਹੀ ਕਈ ਵਾਰ ਫੋਨ 'ਚ ਪੈਸੇ ਨਾ ਹੋਣ ਕਾਰਨ ਸਾਨੂੰ ਸਲੰਡਰ ਵੀ ਨਹੀਂ ਮਿਲਦਾ ਕਿਰਪਾ ਕਰਕੇ ਆਨਲਾਈਨ ਸਿਸਟਮ ਨੂੰ ਸਹੀ ਕੀਤਾ ਜਾਵੇ ਕਿਉਂਕਿ ਕਈ ਅਜਿਹੀ ਮੁਸ਼ਕਿਲਾਂ ਕਾਰਨ ਕਈ ਇਹਦੇ ਫੋਨਾਂ 'ਚ ਬੈਲੈਂਸ ਨਾ ਹੋਣ ਕਾਰਨ ਕਈਆਂ ਨੂੰ ਗੈਸ ਸਲੰਡਰ ਵੀ ਆਨਲਾਈਨ ਦੀ ਬਜਾਏ